ਪੰਜਾਬੀ ਭਾਸ਼ਾ ਵਿੱਚ ਆਮ ਵਾਕੰਸ਼ ਤਾਂ ਵੀ ਤੁਸੀਂ ਅੱਜ ਸਾਰਾ ਦਿਨ ਕੀ ਕੀਤਾ ਤੁਸੀਂ ਕੀ ਖਾਣਾ ਪਸੰਦ ਕਰੋਂਗੇ ਤੁਹਾਡਾ ਅੱਜ ਦਾ ਦਿਨ ਕਿਵੇਂ ਰਿਹਾ ਆਪਾਂ ਡੇਲੀ ਦੀ ਲਾਈਫ ਦੇ ਵਿੱਚ ਆਹੀ ਕੁਛ ਬੋਲਦੇ ਹਾਂ ਅਤੇ ਮੁਹਾਵਰੇ ਵੀ ਈਦ ਦਾ ਚੰਨ ਹੋਣਾ ਕਈ ਦਿਨਾਂ ਬਾਅਦ ਮਿਲਣਾ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਤੁਸੀਂ ਈਦ ਦਾ ਚੰਨ ਹੋ ਗਏ ਸੀ ਦੰਦ ਖੱਟੇ ਕਰਨੇ ਉੱਖੜ ਜੰਮਣ ਕੰਧਾਂ ਕੰਬਣ ਦੁਨੀਆਂ ਨੂੰ ਇੱਕ ਪਾਸੇ ਦਾਤੀ ਨੂੰ ਇੱਕ ਪਾਸੇ ਦੰਦੇ ਦੁਨੀਆਂ ਨੂੰ ਦੋ ਪਾਸੇ ਦੰਦੇ ਐਵੇਂ ਦੇ ਜਿਹੜੇ ਮੁਹਾਵਰੇ ਨੇ ਕਹਾਵਤਾਂ ਨੇਗੀਆਂ ਵਾਕੇਸ਼ ਨੇਗੇ ਇਹ ਸਾਰੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਗੱਲਬਾਤ ਕਰਨ ਲਈ ਵਰਤੇ ਜਾਂਦੇ ਹਨ ਜਿਵੇਂ ਆਪਾਂ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਥਿਆਇਆ ਦੰਦ ਖੱਟੇ ਕਰਨੇ ਇਹ ਸਾਰੇ ਡੇਲੀ ਲਾਈਫ ਦੇ ਵਿੱਚ ਵਰਤੇ ਜਾਂਦੇ ਨੇ